ਹੈਲੋ ਸਪਨਾ ਕੀ ਹਾਲ ਹੈ ਬਸ ਵਧੀਆ ਵਧੀਆ ਮੈਂ ਵੀ ਯਾਰ ਸਪਨਾ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਬਹੁਤ ਜ਼ਰੂਰੀ ਯਾਰ ਦੇਖੋ ਹੁਣ ਅਸੀਂ ਪਲੱਸ ਟੂ ਦੋਵਾਂ ਨੇ ਕਰ ਲਈ ਹੈ ਅੱਗੇ ਮੈਂ ਸੋਚ ਰਹੀ ਕਿ ਅਪ ਆਪਾਂ ਕੋਈ ਮੈਡੀਕਲ ਕੌਲਜ ਦੇ ਵਿੱਚ ਅਡਮੀਸ਼ਨ ਲਈਏ ਹੈ ਨਾ ਦਾਖ਼ਲਾ ਭਰੀਏ ਅਤੇ ਤੁਸੀਂ ਕੁਛ ਦੇਖਿਆ ਆਪਣੇ ਆਸ ਪਾਸ ਕੋਈ ਲੱਗਾ ਤੁਹਾਨੂੰ ਕੋਈ ਕੌਲਜ ਵਧੀਆ ਜਿੱਥੇ ਆਪਾਂ ਦਾਖ਼ਲਾ ਲੈ ਸਕਦੇ ਹਾਂ ਅੱਛਾ ਮੈਂ ਵੈਸੇ ਪਤਾ ਕੀਤਾ ਸੀਗਾ ਅਤੇ ਪਤਾ ਕਰਨ ਦੌਰਾਨ ਮੈਨੂੰ ਪਤਾ ਲੱਗਾ ਕਿ ਸਾਡੇ ਨੇੜੇ ਇੱਕ ਤਾਂ ਐੱਸ ਡੀ ਕੌਲਜ ਹੈ ਇੱਕ ਅਮਨ ਭੱਲਾ ਕੌਲਜ ਹੈ ਔਰ ਇੱਕ ਬੇਅੰਤ ਕੌਲਜ ਹੈ ਇਹਨਾਂ ਦੇ ਵਿੱਚ ਮ ਮੈਡੀਕਲ ਫੈਸਿਲੀ ਮੈਡੀਕਲ ਹੈਗਾ ਹੈ ਅਤੇ ਜੇ ਆਪਾਂ ਐਡਮਿਸ਼ਨ ਇੱਥੇ ਲੈਂਦੇ ਹਾਂ ਤਾਂ ਸਾਡਾ ਵਧੀਆ ਰਹੇਗਾ ਇੱਥੇ ਤੁਸੀਂ ਕੀ ਵਿਚਾਰ ਦੱਸਦੇ ਇਹਦੇ ਵਿੱਚ ਆਪਣੇ ਹਾਂ ਫਿਰ ਆਪਾਂ ਇੱਕ ਵਾਰੀ ਜਾ ਕੇ ਜਾਂਚ ਪੜਤਾਲ ਕਰ ਆਉਂਦੇ ਹਾਂ ਅਤੇ ਫਿਰ ਜਾ ਕੇ ਅਸੀਂ ਅੱਗੇ ਦਾ ਦਾਖ਼ਲਾ ਲੈ ਲਵਾਂਗੇ ਹੈ ਨਾ ਹਾਂਜੀ ਠੀਕ ਹੈ ਚਲੋ ਸਪਨਾ ਫਿਰ ਠੀਕ ਹੈ ਓਕੇ ਬਾਏ